ਸਾਡੇ ਇਲਾਕੇ ਦਾ ਐੱਮ ਐੱਲ ਏ ਆ ਜਿਹੜੇ ਕੁਲਵੰਤ ਸਿੰਘ ਜੀ ਉਹ ਬਹੁਤੇ ਸਾਨੂੰ ਪਸੰਦ ਨਹੀਂ ਆਏ ਹੈ ਐਨਾ ਟਾਈਮ ਹੋ ਗਿਆ ਬਣਿਆ ਨੂੰ ਉਹਨਾਂ ਨੂੰ ਐੱਮ ਐੱਲ ਏ ਪਰ ਘਰ ਵ ਸਾਡੇ ਇੱਥੇ ਇਲਾਕੇ 'ਚ ਉਹਨਾਂ ਨੇ ਬਹੁਤਾ ਕੁਛ ਕੀਤਾ ਨਹੀਂ ਹੈਗਾ ਔਰ ਨਾ ਹੀ ਕਦੇ ਦਿਖਦੇ ਆ ਨਾ ਕਿਸੇ ਨੂੰ ਮਿਲਦੇ ਆ ਉਹ ਪਹਿਲੇ ਸਾਡੇ ਜਿਹੜੇ ਐੱਮ ਐੱਲ ਏ ਸੀ ਉਹ ਸਾਨੂੰ ਬਹੁਤ ਪਸੰਦ ਸੀ ਔਰ ਸਾਡੇ ਆਉਂਦੇ ਸੀ ਸਾਡੇ ਤਾਂ ਪਿੰਡ ਵੀ ਉਹਨਾਂ ਨੇ ਗੋਦ ਲਿਆ ਵਾ ਸੀ ਔਰ ਹੁਣ ਉਹਨਾਂ ਕੋਲ ਪਾਵਰ ਨਹੀਂ ਇਸ ਕਰਕੇ ਸਾਡਾ ਪਿੰਡ ਦਾ ਵਿਕਾਸ ਵੀ ਉੱਥੇ ਰੁਕਿਆ ਪਿਆ ਕੁਲਵੰਤ ਸਿੰਘ ਜੀ ਬਿਲਕੁਲ ਸਾਡੇ ਘ ਆ ਕੇ ਨਹੀਂ ਖੜ੍ਹੇ ਇੱਥੇ ਜਿੱਦੇ ਦੇ ਬਣੇ ਹੈ